ਇੱਕ ਫੋਟੋ ਕਦੇ ਵੀ ਕਦੇ ਵੀ ਨਹੀਂ ਅਸਲ ਚੀਜ਼ ਨੂੰ ਡਰਾਇੰਗ ਜਾਂ ਪੇਂਟ ਕਰਨ ਦੇ ਸ਼ਾਨਦਾਰ ਅਨੁਭਵ ਦੀ ਥਾਂ ਨਹੀਂ ਲੈ ਸਕਦੀ ਭਾਵੇਂ ਇਹ ਮਨੁੱਖ ਹੋਵੇ ਫੁੱਲ ਹੋਵੇ ਕੋਈ ਲੈਂਡਸਕੇਪ ਹੋਵੇ ਕਦੀ ਨਹੀਂ ਇੱਕ ਫੋਟੋ ਸਮੇਂ ਵਿੱਚ ਸਨੈਪਸ਼ਾਟ ਹੁੰਦੀ ਹੈ ਇੱਕ ਖਾਸ ਪਲ ਦੀ ਇਹ ਉਸ ਪਲ ਨੂੰ ਸਮੇਂ ਵਿੱਚ ਫਿਕਸ ਕਰਦੀ ਹੈ ਅਤੇ ਛਾਂ ਦੇ ਰੂਪ ਵਿੱਚ ਰੌਸ਼ਨੀ ਦੇ ਪ੍ਰਭਾਵਾਂ ਨੂੰ ਪੜ੍ਹਦੀ ਹੈ ਸਰੀਰ ਦੀ ਇੱਕ ਸਹੀ ਰੂਪ ਰੇਖਾ ਹੈ ਚਾਹੇ ਸਰੀਰ ਹੀ ਸਮਝ ਲਵੋ ਉਹਨੂੰ ਪਰ ਅਸਲ ਜੀਵਤ ਵਿਅਕਤੀ ਬਹੁਤ ਸਾਰੀਆਂ ਚੀਜ਼ਾਂ ਹਨ ਪਹਿਲਾਂ ਮਾਸ ਅਤੇ ਹੱਡੀ ਦੀ ਇੱਕ ਬਣਤਰ ਇੱਕ ਪਿੰਜਰ ਅਤੇ ਮਾਸਪੇਸ਼ੀਆਂ ਦੇ ਨਾਲ ਫਿਰ ਚਮੜੀ ਇੱਕ ਸਾਹ ਲੈਣ ਵਾਲੀ ਪ੍ਰਤੀਬਿੰਬਿਤ ਸਤਹ ਹੈ ਜੋ ਰੌਸ਼ਨੀ ਲੈਂਦੀ ਹੈ ਅਤੇ ਚਮਕਦੀ ਹੈ ਆਲੇ ਦੁਆਲੇ ਦੇ ਰੰਗ ਤੋਂ ਪ੍ਰਤੀਬਿੰਬ ਚੁੱਕਦੀ ਹੈ ਫਲੈਸ਼ਿੰਗ ਅਤੇ ਫਿੱਕੀ ਪੈ ਜਾਂਦੀ ਹੈ ਫਿਰ ਪੋਜ ਅਤੇ ਤਣਾਅ ਦੇ ਖਿੱਚ ਅਤੇ ਕੋਣ ਹਨ ਹਰ ਇੱਕ ਤੁਹਾਡੇ ਸਾਹਮਣੇ ਮਾਡਲ ਇੱਕ ਨਿੱਜੀ ਹੈ ਫਿਰ ਉਸ ਮਾਡਲ ਦਾ ਮੂਡ ਵੀ ਹੈ ਉਸ ਦਿਨ ਉਸ ਸਮੇਂ ਦੇ ਅਨੁਸਾਰ ਜਿਵੇਂ ਤੁਸੀਂ ਉੱਠਦੇ ਹੋ ਬੈਠਦੇ ਹੋ ਪੋਜ਼ ਦਿੰਦੇ ਹੋ ਤੁਹਾਡਾ ਸਰੀਰ ਕਦੇ ਵੀ ਪੂਰੀ ਤਰ੍ਹਾਂ ਸਥਿਰ ਨਹੀਂ ਹੋਵੇਗਾ ਪਰੰਤੂ ਇੱਕ ਚਿੱਤਰ ਸਥਿਰ ਹੁੰਦਾ ਹੈ ਜਦ ਕਿ ਤੁਹਾਡਾ ਸਰੀਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਪੋਜ਼ ਦੌਰਾਨ ਆਪਣਾ ਸੰਤੁਲਨ ਲੱਭ ਲਵੇਗਾ ਤੁਹਾਡੀਆਂ ਮਾਸਪੇਸ਼ੀਆਂ ਅਤੇ ਕੋਈ ਵੀ ਮਾਸ ਲੰਬੇ ਪੋਜ਼ ਦੌਰਾਨ ਗੁਰਤਾਕਰਸ਼ਨ ਨਾਲ ਹੋਲੀ ਹੌਲੀ ਸਥਿਰ ਹੋ ਜਾਵੇਗਾ ਤੁਹਾਡੀ ਬਾਂਹ ਦਾ ਥੋੜ੍ਹਾ ਜਿਹਾ ਮੋੜ ਰੂਪ ਰੇਖਾ ਨੂੰ ਬਦਲ ਸਕਦਾ ਹੈ ਅੰਤ ਵਿੱਚ ਸ਼ਾਇਦ ਤੁਸੀਂ ਆਪਣੇ ਕਲਾਕਾਰਾਂ ਦੀ ਪ੍ਰੇਰਨਾ ਲਵੋਗੇ ਮੈਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸੈਸ਼ਨ ਸਮੇਂ ਉਹਨਾਂ ਦੇ ਮਾਡਲ ਨਾਲ ਪਿਆਰ ਕਰਨ ਲਈ ਉਤਸਾਹਿਤ ਕਰਦਾ ਹਾਂ ਇਹ ਜਿਨਸੀ ਖਿੱਚ ਦਾ ਮਾਮਲਾ ਨਹੀਂ ਹੈ ਪਰੰਤੂ ਇਹ ਇੱਕ ਗੁਣ ਹੈ ਜੋ ਹਰੇਕ ਮਾਡਲ ਵਿੱਚ ਹੁੰਦਾ ਹੈ ਇੱਕ ਸੁੰਦਰਤਾ ਜਿਸ ਦਾ ਰੂੜੀਵਾਦੀ ਧਾਰਨਾਵਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਹਰ ਚੀਜ਼ ਜੋ ਉਹ ਪੈਦਾ ਕਰਦੀ ਹੈ ਜਾਂ ਪੈਦਾ ਕਰ ਸਕਦੀ ਹੈ ਹਰ ਚੀਜ਼ ਨਾਲ ਉਸ ਦਾ ਸਿਰ ਦਾ ਮੋੜ ਉਸ ਦੇ ਵਾਲਾਂ ਦਾ ਡਿੱਗਣਾ ਉਸ ਦੀ ਤਾਕਤ ਉਸ ਦੀ ਕਮਜ਼ੋਰੀ ਉਸ ਦੀ ਚਮਕਦਾਰ ਚਮੜੀ ਨਾਲ ਸੰਬੰਧਿਤ ਹੈ ਕਈ ਵਾਰ ਸਾਹ ਲੈਣਾ ਮੁਸ਼ਕਿਲ ਕਰ ਦਿੰਦਾ ਹੈ ਕਿਉਂਕਿ ਉਹੋ ਜਿਹਾ ਪੋਜ਼ ਜਿਹੜਾ ਸਾਨੂੰ ਚਿੱਤਰ ਬਣਾਉਣ ਲਈ ਲੋੜੀਂਦਾ ਹੁੰਦਾ ਹੈ ਅਤੇ ਸਾਡੇ ਸਾਰਿਆਂ ਲਈ ਕੈਪਚਰ ਕਰਨ ਦੀ ਕੋਸ਼ਿਸ਼ ਕਰਨ ਦੀ ਯੋਗਤਾ ਦਿੰਦਾ ਹੈ ਜੇ ਤੁਸੀਂ ਪੋਜ਼ ਦੇਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਕੁਝ ਪੇਂਟਿੰਗਾਂ ਨੂੰ ਬਣਾਉਣ ਵਿੱਚ ਇੱਕ ਹੈਰਾਨੀ ਦੇਖੋਗੇ ਉਹ ਤੁਹਾਨੂੰ ਕਿੰਨਾ ਮੋਟਾ ਬਣਾਉਂਦੀਆਂ ਹਨ ਤੁਹਾਡੇ ਪੇਟ ਦਾ ਆਕਾਰ ਉਸ ਉਮਰ ਨਾਲ ਜੋੜਦੇ ਹਨ ਇਸ ਨੂੰ ਕਿਸੇ ਵੀ ਤਰ੍ਹਾਂ ਨਿੱਜੀ ਤੌਰ 'ਤੇ ਨਾ ਲਓ ਉਹ ਆਪਣੇ ਸਮਾਨ ਨਾਲ ਆਉਂਦੇ ਹਨ ਉਹ ਸਿੱਖਣ ਦੀ ਯਾਤਰਾ 'ਤੇ ਹਨ ਉਹ ਤੁਹਾਡੀ ਲਾਟ ਲਈ ਕੀੜੇ ਹਨ ਉਹਨਾਂ ਕੋਲ ਉਹ ਕੁਝ ਰੱਖਣ ਦਾ ਹੁਨਰ ਨਹੀਂ ਹੈ ਜੋ ਉਹ ਦੇਖਦੇ ਹਨ ਹੋਰ ਵਧੇਰੇ ਹੁਨਰਮੰਦ ਕਲਾਕਾਰ ਤੁਹਾਡੇ ਕੋਲ ਕੁਝ ਅਜਿਹਾ ਲੈ ਕੇ ਜਾਣਗੇ ਜੋ ਕੁਝ ਗੁਣ ਹੈ ਅਤੇ ਇਸ ਨੂੰ ਵਧਾ ਚੜਾ ਕੇ ਦੱਸਣਗੇ ਤੁਸੀਂ ਆਪਣੇ ਪਹਿਲੇ ਸੈਸ਼ਨ ਤੋਂ ਹੈਰਾਨ ਹੋਵੋਗੇ ਕਿ ਤੁਸੀਂ ਕਿਹੋ ਜਿਹੇ ਦਿਖਦੇ ਹੋ ਪਰ ਅਜੋਕੇ ਸਮੇਂ 'ਚ ਤੁਸੀਂ ਜੋ ਚਿੱਤਰ ਦੀਵਾਰ 'ਤੇ ਲੱਗੇ ਦੇ ਹਿਸਾਬ ਨਾਲ ਪੇਂਟਿੰਗ ਕਰੋਗੇ ਅਤੇ ਜੋ ਤੁਸੀਂ ਲਾਈਵ ਫੋਟੋ ਦੇਖ ਕੇ ਬਣਾਓਗੇ ਉਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਕੁਝ ਇੰਨਾ ਸੁੰਦਰ ਅਤੇ ਖਾਸ ਹੋਵੇਗਾ ਕਿ ਤੁਹਾਡੇ ਦਿਲ ਨੂੰ ਛੂ ਲਵੇਗਾ ਅਤੇ ਕਈ ਵਾਰ ਤੁਸੀਂ ਇੱਕ ਤਸਵੀਰ ਨੂੰ ਬਿਲਕੁਲ ਪਸੰਦ ਕਰੋਗੇ ਅਤੇ ਸੋਚੋਗੇ ਕੀ ਇਹ ਪੂਰੀ ਤਰ੍ਹਾਂ ਤੁਸੀਂ ਹੋ ਮੈਂ ਮਾਡਲ ਨੂੰ ਪੇਂਟਿੰਗ ਜਾਂ ਸਕੈਚ ਦਾ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜੇਕਰ ਅਜਿਹਾ ਨਾ ਵੀ ਹੋਵੇ ਤਾਂ ਮੈਂ ਨਿਰਾਸ਼ ਨਹੀਂ ਹੁੰਦਾ ਸਗੋਂ ਉਸ 'ਤੇ ਦੁਬਾਰਾ ਆਪਣਾ ਪੂਰਾ ਜ਼ੋਰ ਲਗਾ ਕੇ ਉਸ ਸਰੀਰ ਦੇ ਹਿਸਾਬ ਨਾਲ ਮੋਹਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਧੰਨਵਾਦ